ਹੈਲੋ ਸਤਿ ਸ਼੍ਰੀ ਅਕਾਲ ਜੀ ਬੀ ਐੱਸ ਲੱਕੀ ਢਾਬੇ ਤੋਂ ਬੋਲ ਰਏ ਹੋ ਹਾਂਜੀ ਮੈਂ ਇੱਕ ਟੇਬਲ ਬੁੱਕ ਕਰਨਾ ਤਾ ਜੀ ਮੇਰਾ ਅੱਜ ਜਨਮ ਦਿਨ ਹੈ ਮੈਂ ਆਪਣੇ ਜਨਮ ਦਿਨ 'ਤੇ ਆਪਣੀ ਫੈਮਲੀ ਨਾਲ ਤੁਹਾਡੇ ਢਾਬੇ 'ਤੇ ਰੋਟੀ ਖਾਣ ਆਉਣਾ ਹੈ ਜਿਸ ਵਿੱਚ ਮੇਰੇ ਬੱਚੇ ਮੇਰੀ ਵਾਈਫ ਮੇਰੇ ਮੰਮੀ ਡੈਡੀ ਹੋਣਗੇ ਔਰ ਤੁਹਾਡੇ ਢਾਬੇ 'ਤੇ ਰੋਟੀ ਖਾਣ ਆਉਣਾ ਔਰ ਕੇਕ ਆਰਡਰ ਕਰਨਾ ਹੈ ਕੀ ਤੁਹਾਡੇ ਕੋਲੋਂ ਕੇਕ ਮਿਲ ਜੇਗਾ ਔਰ ਸਨੈਕਸ ਵਿੱਚ ਸਾਨੂੰ ਮਨਚੂਰੀਅਨ ਸਪਰਿੰਗ ਰੋਲ ਵਗੈਰਾ ਵੀ ਚਾਹੀਦੇ ਹਨ ਔਰ ਰਾਤ ਦੀ ਰੋਟੀ ਤੁਹਾਡੇ ਢਾਬੇ 'ਤੇ ਹੀ ਖਾਵਾਂਗੇ ਜਿਸ ਵਿੱਚ ਸ਼ਾਹੀ ਪਨੀਰ ਦਾਲ ਮੱਖਣੀ ਤੰਦੂਰੀ ਰੋਟੀ ਸਾਨੂੰ ਚਾਹੀਦੇ ਹਨ